ਆਪਣੇ ਬਗੀਚੇ ਨੂੰ ਸੰਭਾਲਣ ਲਈ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਕਦੇ ਚਿੱਟੀ ਭੁੰਡੀ ਕਦੇ ਤੇਲਾ ਅਤੇ ਕਈ ਕਦੇ ਕਦੇ ਸਿਉਂਕ ਵੀ ਜੜਾਂ ਖਾ ਜਾਂਦੀ ਹੈ ਕਈ ਵਾਰ ਜੇ ਕਿਧਰੇ ਜਾਣਾ ਪਵੇ ਤਾਂ ਪਾਣੀ ਨਾ ਦੇਣ ਦੀ ਮੁਸ਼ਕਿਲ ਅਤੇ ਟੈਂਸ਼ਨ ਅਤੇ ਆਪਣੇ ਕਿਸੇ ਦੇ ਤਰਲੇ ਵੀ ਕਰਨੇ ਪੈਂਦੇ ਨੇ ਆਪਣੇ ਬਗੀਚੇ ਵਿੱਚ ਕੰਮ ਕਰਦੇ ਹੋਏ ਕਈ ਵਾਰ ਇੰਨਾਂ ਮੱਛਰ ਕੱਟਦਾ ਏ ਕਿ ਵਿੱਚੇ ਛੱਡ ਕੇ ਭੱਜਣ ਨੂੰ ਮਨ ਕਰਦਾ ਕਦੇ ਕਦੇ ਕੋਈ ਬੂਟਾ ਪੂਰੇ ਟਾਈਮ 'ਤੇ ਹਰਾ ਹੀ ਨਹੀਂ ਹੁੰਦਾ ਅਤੇ ਕਦੇ ਕੋਈ ਬੀਜ ਪੁੰਗਰਦਾ ਹੀ ਨਹੀਂ ਅਤੇ ਕਦੇ ਕਦੇ ਕੀੜੇ ਮਕੌੜੇ ਸਾਰੇ ਬੀਜ ਹੀ ਖਾ ਜਾਂਦੇ ਨੇ ਕਿਸੇ ਕਿਸੇ ਪੌਦੇ ਦੀਆਂ ਜੜਾਂ ਅਚਾਈ ਵੱਧਦੀਆਂ ਲੱਗਦੀਆਂ ਨੇ ਬਗੀਚੇ ਵਿੱਚ ਪੈਸਟੈਸਾਈਜ਼ ਦੀ ਵਰਤੋਂ ਕੀਤੇ ਬਿਨਾਂ ਉਸਦੀ ਪੂਰੀ ਤਰ੍ਹਾਂ ਦੇਖਭਾਲ ਕਰਨਾ ਮੁਸ਼ਕਿਲ ਜਿਹਾ ਹੋ ਜਾਂਦਾ ਕਿਉਂਕਿ ਕੀੜੇ ਮਕੌੜੇ ਘਰੇਲੂ ਨੁਸਖਿਆਂ ਨਾਲ ਪੂਰੀ ਤਰ੍ਹਾਂ ਕਾਬੂ ਨਹੀਂ ਆਉਂਦੇ ਅਤੇ ਘਰੇਲੂ ਨੁਸਖੇ ਕਰਨੇ ਵੀ ਬੜੇ ਥੋੜ੍ਹੇ ਮੁਸ਼ਕਿਲ ਲੱਗਦੇ ਨੇ ਜਿਹਨਾਂ ਲਈ ਟਾਈਮ ਦੇਣਾ ਪੈਂਦਾ ਅਤੇ ਘਰੇਲੂ ਖਾਦ ਬਣਾਉਣ ਨਾਲ ਕੀੜੇ ਵੀ ਕਈ ਵਾਰੀ ਨਾਲ ਨਾਲ ਪੈਦਾ ਹੋ ਜਾਂਦੇ ਨੇ